ਮੈਂ ਪ੍ਰੈਸ਼ਰ ਕੁੱਕਰ ਦੀ ਵੀ ਵਰਤੋਂ ਕਰਦੀ ਹਾਂ ਅਤੇ ਖੁੱਲ੍ਹੇ ਭਾਂਡਿਆਂ ਵਿੱਚ ਪਕਾਏ ਹੋਏ ਭੋ ਭੋਜਨ ਨੂੰ ਵੀ ਤਰਜੀਹ ਦਿੰਦੀ ਹਾਂ ਅੱਜ ਕੱਲ੍ਹ ਹਰ ਇੱਕ ਨੂੰ ਆਪਣਾ ਸਮੇਂ ਬਚਾਉਣ ਦੀ ਬਹੁਤ ਜਲਦੀ ਹੈ ਹਰ ਇੱਕ ਕੋਈ ਸਮਾਂ ਬਚਾਉਣ ਦੇ ਚੱਕਰ 'ਚ ਲੱਗਿਆ ਹੈ ਅਤੇ ਇਸ ਕਰਕੇ ਪ੍ਰੈਸ਼ਰ ਕੁੱਕਰ ਲੋਕਾਂ ਨੂੰ ਆਸਾਨ ਲੱਗਦਾ ਹੈ ਅਤੇ ਪਰ ਖੁੱਲ੍ਹੇ ਭਾਂਡਿਆਂ ਵਿੱਚ ਪਕਾਇਆ ਹੋਇਆ ਭੋਜਨ ਵਧੀਆ ਵੀ ਹੁੰਦਾ ਹੈ ਇਸਦੇ ਵਿੱਚ ਟਾਇਮ ਵੀ ਕਾਫ਼ੀ ਜ਼ਾਇਆ ਹੁੰਦਾ ਹੈ ਪ੍ਰੈਸ਼ਰ ਕੁੱਕਰ ਦੇ ਵਿੱਚ ਜਿਹੜੀ ਚੀਜ਼ ਦਸ ਮਿੰਟ 'ਚ ਬਣ ਕੇ ਤਿਆਰ ਹੋ ਜਾਂਦੀ ਹੈ ਉਹੀ ਚੀਜ਼ ਸ ਖੁਲ੍ਹੇ ਭਾਂਡਿਆ ਵਿੱਚ ਪਕਾਉਣ ਲਈ ਸਾਨੂੰ ਇੱਕ ਤੋਂ ਡੇਢ ਘੰਟਾ ਵੀ ਲੱਗ ਜਾਂਦਾ ਹੈ ਪਰ ਜਿਹੜੀ ਚੀਜ਼ ਦਾ ਸਵਾਦ ਖੁੱਲ੍ਹੇ ਭਾਂਡਿਆਂ ਵਿੱਚ ਹੈ ਉਹ ਪ੍ਰੈਸ਼ਰ ਕੁੱਕਰ ਵਿੱਚ ਨਹੀਂ ਹੈ ਇਸੇ ਕਰਕੇ ਲੋਕ ਅੱਜ ਕੱਲ੍ਹ ਕਾਫ਼ੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪੁਰਾਣੇ ਜ਼ਮਾਨੇ ਵਿੱਚ ਲੋਕ ਖੁੱਲ੍ਹੇ ਭਾਂਡਿਆਂ ਦੀ ਵਰਤੋਂ ਕਰਦੇ ਸਨ ਇਸ ਲਈ ਉਨ੍ਹਾਂ ਦੀ ਉਮਰ ਬਹੁਤ ਲੰਬੀ ਅਤੇ ਉਹ ਬਹੁਤ ਤੰਦਰੁਸਤ ਰਹਿੰਦੇ ਸੀ ਇਸ ਕਾਰਨ ਏ ਇਹੀ ਇਹੀ ਕਾਰਨ ਹੈ ਉਨ੍ਹਾਂ ਦੀ ਤੰਦਰੁਸਤੀ ਦਾ ਅਤੇ ਉਨ੍ਹਾਂ ਦੀ ਲੰਮੀਆਂ ਉਮਰਾਂ ਦਾ ਇਸ ਕਾਰਨ ਉਹ ਬਹੁਤ ਸਾਰਾ ਕੰਮ ਕਰਨ ਦੀ ਸ਼ਮਤਾ ਰੱਖਦੇ ਸਨ ਪਰ ਜਿਹੜੇ ਅੱਜ ਕੱਲ੍ਹ ਦੇ ਲੋਕ ਹਨ ਇਹਨਾਂ ਨੂੰ ਨਾ ਹੀ ਤਾਂ ਪੋਸ਼ਣ ਮਿਲਦਾ ਹੈ ਅਤੇ ਨਾ ਹੀ ਜੀਭ ਦਾ ਸਵਾਦ ਇਹ ਜੀਭ ਦਾ ਸਵਾਦ ਲੈਣ ਲਈ ਬਾਹਰ ਜਾਂਦੇ ਹਾਂ ਜਾਂ ਫਿਰ ਘਰ ਹੀ ਪ੍ਰੈਸ਼ਰ ਕੁੱਕਰ ਦੀ ਆੜ ਵਿੱਚ ਬੈਠੇ ਰਹਿੰਦੇ ਹਨ ਪਰ ਜਿਹੜਾ ਪ੍ਰੈਸ਼ਰ ਕੁੱਕਰ ਹੈ ਉਹ ਕਾਫ਼ੀ ਸਾਰੇ ਪੋਸ਼ਣ ਤੱਤਵਾਂ ਨੂੰ ਅੰਦਰ ਹੀ ਖ਼ਤਮ ਕਰ ਦਿੰਦਾ ਹੈ ਪਰ ਜਿਹੜੀ ਚੀਜ਼ ਦਾ ਮਜ਼ਾ ਖੁੱਲ੍ਹੇ ਭਾਂਡਿਆਂ ਵਿੱਚ ਰਿਝਣ ਦਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਖਾਣ ਦਾ ਹੁੰਦਾ ਹੈ ਉਹ ਪ੍ਰੈਸ਼ਰ ਕੁੱਕਰ ਵਿੱਚ ਨਹੀਂ ਮੈਂ ਦੋਨੇ ਚੀਜ਼ਾਂ ਦਾ ਵਰਤ ਵਰਤੋਂ ਕਰਦੀ ਹਾਂ ਪਰ ਮੈਨੂੰ ਜ਼ਿਆਦਾਤਰ ਖੁੱਲ੍ਹੇ ਭਾਂਡਿਆਂ ਵਿੱਚ ਪਕਾਏ ਹੋਏ ਭੋਜਨ ਦਾ ਹੀ ਮਜ਼ਾ ਆਉਂਦਾ ਹੈ ਜਿਹੜਾ ਭੋਜਨ ਇੱਕ ਘੰਟੇ ਵਿੱਚ ਬਣ ਕੇ ਤਿਆਰ ਹੁੰਦਾ ਹੈ ਉਹ ਭਲਾ ਕਿਵੇਂ ਦਸ ਮਿੰਟ ਵਿੱਚ ਹੀ ਸਵਾਦ ਲੱਗ ਸਕਦਾ ਹੈ ਕਿਸੇ ਨੂੰ ਇਹੀ ਕਾਰਨ ਹੈ ਕਿ ਜਿਹੜਾ ਭੋਜਨ ਸਾਨੂੰ ਖੁੱਲ੍ਹੇ ਭਾਂਡਿਆਂ ਵਿੱਚ ਵਧੀਆ ਲੱਗਦਾ ਹੈ ਉਹ ਪ੍ਰੈਸ਼ਰ ਕੁੱਕਰ ਵਿੱਚ ਨਹੀਂ ਲੱਗਦਾ ਅਤੇ ਇਹਦੇ ਪੋਸ਼ਣ ਤੱਤਵ ਵੀ ਖ਼ਤਮ ਹੋ ਜਾਂਦੇ ਹਨ